ਪੰਜਾਬ ਵਿੱਚ ਇੰਡਸਟਰੀ ਵਾਸਤੇ ਹੋਜਰੀ ਲੁਧਿਆਣਾ ਸਾਈਕਲ ਇੰਡਸਟਰੀ ਲੁਧਿਆਣਾ ਖੇਡਾਂ ਦੇ ਸਮਾਨ ਵਾਸਤੇ ਜਲੰਧਰ ਰੇਲ ਕੋਚ ਫੈਕਟਰੀ ਕਪੂਰਥਲਾ ਇਹ ਵਰਨਣਯੋਗ ਹਨ ਜੋ ਕਿ ਹੋਜਰੀ ਲੁਧਿਆਣਾ ਦੀ ਵਰਲਡ ਦੇ ਵਿੱਚ ਮਾਲ ਜਾਂਦਾ ਹੈ ਸਾਰੇ ਇੰਡੀਆ ਛੱਡ ਕੇ ਬਾਹਰ ਵਰਲਡ ਵਿੱਚ ਬਹੁਤ ਮੁਲਕਾਂ 'ਚ ਮਾਲ ਜਾਂਦਾ ਹੈ ਜਿੱਥੇ ਬੜੇ ਬੜੇ ਵੱਡੀਆਂ ਫੈਕਟਰੀਆਂ ਹਨ ਜਿਨ੍ਹਾਂ ਦਾ ਮਾਲ ਹਰ ਸਟੇਟ ਦੇ ਵਿੱਚ ਹਰ ਮੁਲਕ ਦੇ ਵਿੱਚ ਜਾਂਦਾ ਹੈ ਅਤੇ ਉੱਥੇ ਲੋਕਾਂ ਨੂੰ ਰੁਜ਼ਗਾਰ ਬਹੁਤ ਮਿਲਦਾ ਹੈ ਔਰ ਸਪੋਰਟਸ ਜਲੰਧਰ ਫੈਕਟਰੀ ਜਿਹੜੀ ਹੈ ਉਹ ਵੀ ਖੇਡਾਂ ਦਾ ਸਮਾਨ ਜਿਹੜਾ ਹੈ ਜੋ ਉ ਆਲ ਇੰਡੀਆ ਦੇ ਵਿੱਚ ਛੱਡ ਕੇ ਬਾਹਰ ਦੇ ਮੁਲਕਾਂ 'ਚ ਬਹੁਤ ਜਾਂਦਾ ਹੈ ਜਿੱਥੇ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ ਸਾਈਕਲ ਇੰਡਸਟਰੀ ਇੰਡੀਆ ਦੀ ਜਿਹੜੀ ਇਹ ਸਭ ਨਾਲੋਂ ਵੱਡੀ ਲੁਧਿਆਣੇ ਹੈ ਉੱਥੇ ਬੜੇ ਵੱਡੀਆਂ ਫੈਕਟਰੀਆਂ ਹਨ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਰੁਜ਼ਗਾਰ ਵਾਸਤੇ ਲੋਕਾਂ ਨੂੰ ਬੜੀ ਦੂਰੋਂ ਨੇੜਿਓਂ ਸਾਰੇ ਆਉਣਾ ਪੈਂਦਾ ਹੈ ਰੁਜ਼ਗਾਰ ਮਿਲਦਾ ਹੈ ਅਤੇ ਰੇਲ ਕੋਚ ਫੈਕਟਰੀ ਇੰਡੀਆ ਦੀ ਰੇਲਵੇ ਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੀ ਹੈ ਜਿਹਦੇ 'ਚ ਬੜੇ ਬੜੇ ਦੂਰੋਂ ਲੋਕ ਆਣ ਕੇ ਉੱਥੇ ਰੁਜ਼ਗਾਰ ਕਰਦੇ ਹਨ ਅਤੇ ਉਹਨਾਂ ਨੂੰ ਰੁਜ਼ਗਾਰ ਮਿਲਣ ਦੇ ਨਾਲ ਘਰ ਦੇ ਕੰਮ ਕਾਰ ਵਿੱਚ